ਪੰਜਾਬ ਪੰਜਾਬ ਵਿੱਚ ਨਿਊਜ਼ ਮੀਡੀਆ ਸਿੱਖਿਆ ਅਤੇ ਸਿਹਤ ਸ ਸੰਭਾਲ ਨਾਲ ਸੰਬੰਧਿਤ ਮੁੱਦਿਆਂ ਨੂੰ ਕਵਰ ਕਰਦੀ ਹੈ ਸਿੱਖਿਆ ਵਿੱਚ ਨਿਊਜ਼ ਨਿਊਜ਼ ਪੰਜਾਬ ਨਿਊਜ਼ ਮੀਡੀਆ ਪੇਪਰ ਜਾਅਲੀ ਪੇਪਰ ਬਣਾ ਕੇ ਛਾਪ ਦਿੰਦੀਆਂ ਹਨ ਅਤੇ ਵੱਡੀਆਂ ਵੱਡੀਆਂ ਕਲਾਸਾਂ ਜਿਵੇਂ ਟੈਂਨਥ ਪਲਸ ਟੂ ਬੀਏ ਬੀਐਡ ਬੀਕੌਮ ਵਰਗੇ ਕਲਾਸਾਂ ਦੇ ਪੇਪਰਸ ਨੂੰ ਲੀਕ ਕਰਦੀਆਂ ਹਨ ਜਿਸ ਕਰਕੇ ਬਹੁਤ ਸੇ ਅਧਿਆਪਕ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਟੁੱਟ ਜਾਂਦੇ ਹਨ ਜਿਹਨਾਂ ਕਰਕੇ ਉਹ ਪੇਪਰ ਨਹੀਂ ਦੇ ਦੇ ਸਕਦੇ ਜਿਹਨਾਂ ਕਰਕੇ ਜਿਸ ਕਰਕੇ ਪੇਪਰ ਰੱਦ ਹੋ ਜਾਂਦੇ ਹਨ ਸਿੱਖਿਆ ਸਿਹਤ ਸਿਹਤ ਮੈਡੀਕਲ ਸਿੱਖਿਆ ਦੇ ਖੋਜ ਅਤੇ ਸਿਖ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਪ ਡਾਕਟਰ ਬਲਵੀਰ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਨੂੰ ਵਿਦੇਸ਼ ਮੈਡੀਕਲ ਗ੍ਰੈਜੁਏਟਾਂ ਨੂੰ ਇੰਟਰਨਲਸ਼ਿਪ ਅਲਾਇਸਮੈਂਟ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤੇ ਅਤੇ ਵੱਧ ਤੋਂ ਵੱਧ ਉਪਲਬਧ ਇੰਟਰਨਲਸ਼ਿਪ ਸਲਾਫਟ ਯਕੀਨੀ ਬਣਾਉਣ ਲਈ ਪੰਜਾਬ ਦੇ ਚੰਡੀਗੜ੍ਹ ਭਰ ਦੀਆਂ ਮੈਡੀਕਲ ਸੰਸਥਾਵਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਮੈਡੀਕਲ ਸੰਸਥਾਵਾਂ ਵਿੱਚ ਬਹੁਤ ਅੱਜ ਕੱਲ੍ਹ ਥਾਂ ਥਾਂ 'ਤੇ ਡਾਕਟਰ ਬਲਵੀਰ ਸਿੰਘ ਦੇ ਹੁਕਮ ਅਨੁਸਾਰ ਨਿਰ ਨਿਰਦੇਸ਼ਾਂ ਅਨੁਸਾਰ ਜਗ੍ਹਾ ਜਗ੍ਹਾ ਇੱਥੇ ਕੇ ਕੇਅਰ ਸੈਂਟਰ ਖੁੱਲ੍ਹ ਗਏ ਹਨ ਸਿਹਤ ਕੇਅਰ ਸੈਂਟਰ ਖੁੱਲ੍ਹ ਗਏ ਹਨ ਉੱਥੇ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਦੀ ਪੂਰੀ ਪੂਰੇ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਦਵਾਈ ਫਲ ਫਰੂਟਸ ਆਦਿ ਦਾ ਧਿਆਨ ਪੂਰੀ ਚੰਗੀ ਤਰ੍ਹਾਂ ਰੱਖਿਆ ਜਾਂਦਾ ਹੈ ਉਹਨਾਂ ਦੀ ਪੂਰੀ ਕੇਅਰ ਕੀਤੀ ਜਾਂਦੀ ਹੈ ਬਾਕੀ ਡਾਕਟਰ ਅੱਜ ਦੇ ਜਿਹੜੇ ਆਪਣੇ ਡਾਕਟਰ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਹਨ ਉਹਨਾਂ ਨੇ ਬਹੁਤ ਹੀ ਯੋਗਦਾਨ ਪਾ ਰਹੇ ਹਨ ਉਹਨਾਂ ਦੀ ਕਿਰਪਾ ਨਾਲ ਬਹੁਤ ਸੇ ਮਰੀਜ਼ ਠੀਕ ਹੋ ਰਹੇ ਹਨ